ਹੈਲੋ ਹਾਂਜੀ ਸਰ ਮੈਂ ਪੁੱਛਣਾ ਸੀ ਨਾ ਕਿੰਨਾ ਚਿਰ ਹੋ ਗਿਆ ਮੈਂ ਕੈਬ ਬੁੱਕ ਕਰੀ ਸੀ ਅਤੇ ਇੰਨੀ ਦੇਰ ਕਿਉਂ ਹੋ ਗਈ ਮੈਂ ਆਇਆ ਸੀ ਐਡੇ ਬੜੇ ਸ਼ਹਿਰ 'ਚ ਆਇਆ ਹੈ ਨਾ ਸ਼ਪੈਸ਼ਲ ਹੈ ਨਾ ਅਤੇ ਮੈਨੂੰ ਕਿਸੇ ਨੇ ਕਿਹਾ ਕਿ ਹੈ ਨਾ ਜੇ ਤੂੰ ਜਲਦੀ ਜਾਣਾ ਹੈ ਤਾਂ ਕੈਬ ਬੁੱਕ ਕਰ ਆਹ ਐਪ ਤੋਂ ਮੈਂ ਇਹ ਐਪ ਤੋਂ ਕੈਬ ਬੁੱਕ ਕਰੀ ਹੈ ਨਾ ਅਤੇ ਮੈਂ ਪੈਸੇ ਵੀ ਤੁਹਾਨੂੰ ਪਹਿਲਾਂ ਟ੍ਰਾਂਸਫਰ ਕਰੇ ਹੈ ਨਾ ਗੂਗਲ ਪੇਅ ਕਰੇ ਅਤੇ ਤੁਸੀਂ ਫਿਰ ਵੀ ਨਹੀਂ ਹੈ ਨਾ ਟਾਈਮ ਸਿਰ ਆਏ ਹੁਣ ਅੱਗੇ ਮੇਰਾ ਇੰਟਰਵਿਊ ਹੈ ਹੁਣ ਮੈਂ ਕਿਵੇਂ ਜਾਊਂਗਾ ਜੀ ਇਹ ਗਲਤੀ ਤੁਹਾਡੀ ਹੈ ਨਾ ਹੁਣ ਜੇ ਮੇਰਾ ਇੰਟਰਵਿਊ ਰਹਿ ਗਿਆ ਤਾਂ ਮੈਂ ਕੀ ਕਰੂੰਗਾ ਇੰਨੇ ਬੜੇ ਸ਼ਹਿਰ 'ਚ ਆ ਕੇ ਮੇਰੇ ਪੈਸੇ ਵੀ ਬਰਬਾਦ ਹੋਏ ਸਮਾਂ ਵੀ ਬਰਬਾਦ ਹੋ ਰਿਹਾ ਹੈ ਠੀਕ ਹੈ ਤੁਸੀਂ ਇਹ ਦੱਸੋ ਆਏ ਕਿਉਂ ਨਹੀਂ ਮੈਨੂੰ ਰੀਜ਼ਨ ਦੱਸੋ ਹੈ ਨਾ ਕਿਉਂ ਨਹੀਂ ਆਏ ਕਿ ਲੇਟ ਕਿਉਂ ਹੋ ਗਏ ਇੰਨਾ ਕੀ ਮੈਂ ਬਾਹਰ ਖੜਾ ਰਿਹਾ ਵੇਟ ਕਰਦਾ ਰਿਹਾ ਹੈ ਨਾ ਕੀ ਤੁਸੀਂ ਆ ਰਹੇ ਹੋ ਤੁਸੀਂ ਲੋਕੇਸ਼ਨ ਭੇਜੀ ਤੁਹਾਨੂੰ ਲੋਕੇਸ਼ਨ ਚੱਲ ਕਿਉਂ ਨਹੀਂ ਕਿਉਂ ਨਹੀਂ ਪਹੁੰਚੇ ਹੈਗੇ ਤੁਸੀਂ ਮੈਨੂੰ ਇਹ ਦੱਸੋ ਰੀਜ਼ਨ ਦੱਸੋ ਹੈ ਨਾ ਪਰ ਇਹ ਬਹੁਤ ਗਲਤ ਗੱਲ ਹੈ ਹੈ ਨਾ ਕਿ ਬੰਦੇ ਨੂੰ ਐਵੇਂ ਕੀ ਹੈ ਨਾ ਕਿ ਬੰਦੇ ਨੇ ਪੈਸੇ ਵੀ ਤੁਹਾਨੂੰ ਦੇ ਤੇ ਤੁਸੀਂ ਫਿਰ ਵੀ ਨਹੀਂ ਆਏ ਹੈ ਨਾ ਇਹਦਾ ਰੀਜ਼ਨ ਦੱਸੋ ਹੈ ਨਾ ਬਾਕੀ ਇਹ ਆ ਹੁਣ ਤਾਂ ਚਲੋ ਇੰਟਰਵਿਊ ਮੇਰੀ ਹੈ ਨਾ ਰਹਿ ਗਈ ਹੁਣ ਮੈਂ ਕੀ ਕਰ ਸਕਦਾ ਹੈ ਨਾ ਪਰ ਅੱਗੇ ਤੋਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਹੈ ਨਾ ਅੱਗੇ ਤੋਂ ਕਿਸੇ ਹੋਰ ਨਾਲ ਨਾ ਹੋਵੇ ਇਹ ਗੱਲ